ਜੇ ਪੰਜਾਬ ਦੇ ਕਲਚਰ ਨੂੰ ਦੇਖੀਏ ਤਾਂ ਹੁਣ ਆਧੁਨਿਕਤਾ ਦੇ ਨਾਲ ਨਾਲ ਆਪਾਂ ਪਿੱਛੇ ਉਹ ਕਲਚਰਲੀ ਦੀ ਜਿਹੜੀ ਸਾਰੀ ਚੀਜ਼ਾਂ ਸੀ ਉਹਨਾਂ ਨੂੰ ਪਿੱਛੇ ਛੱਡਦੇ ਜਾ ਰਹੇ ਹਾਂ ਜਿਵੇਂ ਪੰਜਾਬ ਦੇ ਵਿੱਚ ਪੁਰਾਣੇ ਜਦੋਂ ਸਮਿਆਂ 'ਚ ਘਰ ਕੱਚੇ ਹੁੰਦੇ ਸੀ ਅਤੇ ਕੂਆ ਹੁੰਦਾ ਸੀ ਜਿਵੇਂ ਕੂਆ ਖੋਏ ਤੋਂ ਖੂਹ ਤੋਂ ਜਿਵੇਂ ਆਪਾਂ ਖਿੱਚਦੇ ਸੀ ਪਾਣੀ ਅਤੇ ਉਹ ਸਾਰਾ ਇੱਕ ਪੂਰਾ ਸਿਸਟਮ ਸੀ ਜਿਵੇਂ ਰਹਿਟ ਸੀ ਜਿਹਨੂੰ ਰਹਿਟ ਕਹਿੰਦੇ ਹਾਂ ਅਤੇ ਪਾਣੀ ਖਿੱਚਣ ਵਾਸਤੇ ਉਹ ਸਾਰੀਆਂ ਚੀਜ਼ਾਂ ਸੀ ਪਰ ਅੱਜ ਦੀ ਜਨਰੇਸ਼ਨ ਜਿਵੇਂ ਮੋਡਰਨਾਈਜੇਸ਼ਨ ਨਾਲ ਹੁਣ ਖੂਹ ਦੀ ਥਾਂ 'ਤੇ ਹੁਣ ਸਬਮਰਸੀਬਲ ਪੰਪਸ ਆ ਗਏ ਅਤੇ ਖੇਤੀ ਦੇ ਵੀ ਜਿਹੜੇ ਤੰਤਰ ਆ ਉਹ ਸਾਰਾ ਮੈਕੈਨੀਕਲ ਹੋ ਗਿਆ ਅਤੇ ਆਧੁਨਿਕ ਹੋ ਗਿਆ ਜਿਹੜੀ ਕਲਚਰ ਦੀਆਂ ਸਾਰੀਆਂ ਚੀਜ਼ਾਂ ਵਾ ਚੀਜ਼ਾਂ ਸੀ ਉਹ ਸਾਰੀਆਂ ਹੁਣ ਅੱਗੇ ਵਧ ਗਈਆਂ ਅਤੇ ਜਿਵੇਂ ਉਹ ਸਾਰੀ ਪਿੱਛੇ ਛੁੱਟ ਗਈਆਂ ਜਿਵੇਂ ਆਪਾਂ ਅੱਗੇ ਵੱਧ ਗਏ ਪਹਿਲਾਂ ਪੰਜਾਬ ਦੇ ਵਿੱਚ ਕਈ ਥਾਵਾਂ ਤੋਂ ਜਿਵੇਂ ਰਾਜਸਥਾਨ ਤੋਂ ਅਤੇ ਅਤੇ ਰਾਜਸਥਾਨ ਅਤੇ ਹਰਿਆਣੇ ਦੇ ਲਾਗਿਓ ਬੌਡਰ ਤੋਂ ਜਿਵੇਂ ਊਠ ਲੈ ਕੇ ਆਉਂਦੇ ਸੀ ਪਹਿਲਾਂ ਖੇਤੀ ਵਾਸਤੇ ਅਤੇ ਉਹ ਵੀ ਉੱਥੇ ਮੇਲੇ ਲੱਗਦੇ ਸੀ ਪਸ਼ੂ ਮੇਲਾ ਜਿਵੇਂ ਹੁਣ ਡੱਬਵਾਲੀ ਅਤੇ ਜਿਵੇਂ ਮੈਂ ਆਪਣੇ ਆਸੇ ਪਾਸੇ ਡੱਬਵਾਲੀ ਵਿੱਚ ਪਸ਼ੂ ਮੇਲਾ ਲੱਗਦਾ ਹੈ ਅੰਮ੍ਰਿਤਸਰ ਵਿੱਚ ਕਈ ਘੋੜਿਆਂ ਦੇ ਮੇਲੇ ਲੱਗਦੇ ਹੈ ਅਤੇ ਪੰਜਾਬ 'ਚ ਹੋਰ ਕਈ ਹਿੱਸਿਆਂ 'ਚ ਵੀ ਮੇਲੇ ਲੱਗਦੇ ਹੈ ਜਿਹੜੇ ਪੰਜਾਬੀ ਸੱਭਿਆਚਾਰ ਅਤੇ ਇਤਿਹਾਸ ਨੂੰ ਦ ਦਰਸਾਉਂਦੇ ਹੈ ਜਿਵੇਂ ਹੋਲਾ ਮਹੱਲਾ ਦਾ ਇਵੈਂਟ ਹੁੰਦਾ ਹੈ ਅਤੇ ਆਨੰਦਪੁਰ ਸਾਹਿਬ ਵਿੱਚ ਉਹ ਵੀ ਦਿਖਾਉਂਦਾ ਹੈ ਕਿ ਪੰਜਾਬ ਦਾ ਜਿਵੇਂ ਹਿਸਟਰੀ ਕਲਚਰ ਕਿਵੇਂ ਮਿਟ ਮਿਲਟਰੀ ਕਲਚਰ ਸੀ ਕਿਵੇਂ ਉਹਦੇ ਪ੍ਰੋਟੈਕਸ਼ਨ ਵਾਸਤੇ ਇਹ ਸਭ ਹੁੰਦਾ ਰਿਹਾ ਉਹਦੇ ਮਗਰੋਂ ਜਿਹੜੇ ਕਈ ਧਾਰਮਿਕ ਸੰਸਥਾਵਾਂ ਹਨ ਅਤੇ ਸਮਾਜ ਸੇਵਿਕ ਜਿਹੜੇ ਸੰਘ ਹੈ ਅਤੇ ਜਿਹੜੇ ਸਮਾਜ ਦੀ ਸੇਵਾ ਲਈ ਬਣੇ ਸੰਘ ਹੈ ਉਹ ਮਿਲ ਕੇ ਜਿਵੇਂ ਆਪਾਂ ਜਿਹਨੂੰ ਬੜ੍ਹ ਦਾ ਪੇੜ ਕਹਿੰਦੇ ਹਾਂ ਜੇ ਬੜ੍ਹ ਦਾ ਬਰਕਸ਼ ਕਹਿੰਦੇ ਹਾਂ ਜਿਹਨੂੰ ਉਹ ਦਰਖ਼ਤ ਹੈ ਜਿਹੜਾ ਬੜ੍ਹਦਾ ਉਹ ਲਗਾਉਣ ਵਾਸਤੇ ਵੀ ਕਈ ਤਰੀਕੇ ਦੀਆਂ ਜਿਵੇਂ ਬੈਨੀਅਨ ਆਰਟ ਗੈਲਰੀ ਹੈ ਇਹ ਵੀ ਪੰਜਾਬ ਦੇ ਹਿੱਸਿਆਂ 'ਚ ਹੁੰਦੀ ਹੈ ਜਾਂ ਜੱਸਲ ਆਰਟ ਗੈਲਰੀ ਹੈ ਇਸ ਤਰੀਕੇ ਨਾਲ ਪੰਜਾਬ ਦੇ ਵੱਖ ਵੱਖ ਹਿੱਸਿਆਂ 'ਚ ਹੀ ਮਾਝਾ ਮਾਲਵਾ ਅਤੇ ਦੁਆਬਾ ਵਿੱਚ ਕਈ ਤਰੀਕੇ ਦੀ ਇਹ ਹੀ ਪ੍ਰਦਰਸ਼ਨੀਆਂ ਹੁੰਦੀਆਂ ਅਤੇ ਜਿਵੇਂ ਕਢਾਈ ਆ ਫਿਰ ਕਾਫ਼ੀ ਕੁਛ ਚੀਜ਼ ਹੁੰਦਾ ਜੋ ਪੰਜਾਬ ਨੂੰ ਦਰਸਾਉਂਦਾ